ਅ ਬੱਚਿਆਂ ਦੀ ਹੈਲਥ ਦਾ ਖਿਆਲ ਕਰਨਾ ਇੱਕ ਜੋ ਕਿ ਦੇਸ਼ ਦਾ ਭਵਿੱਖ ਖਾਨ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਇਹ ਅ ਜਿਹੜਾ ਅ ਗੈਰ ਸਵੱਛ ਮਾਹੌਲ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਜਿੱਥੇ ਆਸ ਪਾਸ ਗੰਦਗੀ ਹੋਵੇ ਜਾਂ ਮੱਛਰਾਂ ਵਾਲਾ ਹੋਵੇ ਏਰ ਇਲਾਕਾ ਏਰੀਆ ਹੋਵੇ ਜਾਂ ਉੱਥੇ ਕੋਈ ਅ ਰੂਮ ਦੇ ਵਿੱਚ ਕੋਈ ਅੱਛੀ ਫੈਸਿਲਟੀਜ਼ ਨਾ ਹੋਣ ਗੰਦਗੀ ਹੋਵੇ ਬਦਬੂਦਾਰ ਹੋਵੇ ਇਹੋ ਜਿਹੇ ਮਾਹੌਲ ਤੋਂ ਬਚਾਉਣਾ ਔਰ ਫਿਰ ਉਹਨਾਂ ਨੂੰ ਬੱਚਿਆਂ ਰਹਿੰਦੀ ਕੋਈ ਕਮਜ਼ੋਰੀ ਨਾ ਹੋ ਫਿਜ਼ੀ ਫਿਜ਼ੀਕਲੀ ਕੋਈ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਕੋਈ ਉਹਨੂੰ ਫੀਡ ਪੂਰੀ ਮਿਲਣੀ ਚਾਹੀਦੀ ਮਾਂ ਦਾ ਦੁੱਧ ਮਿਲਣਾ ਚਾਹੀਦਾ ਜਿਹੜਾ ਡੱਬੇ ਦਾ ਦੁੱਧ ਹੈ ਜਾਂ ਦੂਸਰਾ ਦੁੱਧ ਹੈ ਉਹ ਇ ਇਤਨੀ ਮਤਲਬ ਉਹਦੇ ਸਰੀਰ ਵਾਸਤੇ ਕੋਈ ਤੰਦਰੁਸਤੀ ਉਪਜਣਕ ਨਹੀਂ ਹੁੰਦਾ ਇਹ ਅ ਬੱਚੇ ਦਾ ਸ਼ ਬੱਚੇ ਵਿੱਚ ਕੁਛ ਨਾ ਕੁਛ ਕਮਜ਼ੋਰੀਆਂ ਰਹਿ ਜਾਂਦੀਆਂ ਅ ਜਲਦੀ ਹੀ ਤਰ੍ਹਾਂ ਤਰ੍ਹਾਂ ਦੇ ਇਨਫੈਕਸ਼ਨ ਵਗੈਰਾ ਦਾ ਸ਼ਿਕਾਰ ਹੁੰਦਾ ਬੱਚਾ ਜਿਹੜਾ ਕਮਜ਼ੋਰ ਹੁੰਦਾ ਅਤੇ ਸਵੱਛ ਵਾਤਾਵਰਨ ਦੇ ਨਾਲ ਉਹਨੂੰ ਮਜਬੂਤੀ ਵਾਸਤੇ ਚੰਗੀ ਖੁਰਾਕ ਦਾ ਵੀ ਪ੍ਰਬੰਧ ਪ੍ਰਬੰਧ ਹੋਣਾ ਚਾਹੀਦਾ ਹੈ ਮਾਤਾ ਦਾ ਦੁੱਧ ਤਾਂ ਖ਼ਾਸ ਕਰ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਹੋਰ ਕਈ ਜਿਸ ਤਰ੍ਹਾਂ ਅ ਜਿਹੜੀਆਂ ਮੋਸ ਆਪਣੇ ਸਹੀ ਤਰ੍ਹਾਂ ਦੇ ਫ਼ਲ ਫਰੂਟ ਅਤੇ ਉਹਨਾਂ ਦੇ ਥੋੜ੍ਹੇ ਜਿਹੇ ਰਸ ਜਾਂ ਤਰ੍ਹਾਂ ਤਰ੍ਹਾਂ ਦੀਆਂ ਕੋਈ ਚੀਜ਼ਾਂ ਬੱਚਿਆਂ ਨੂੰ ਬਣਾ ਕੇ ਅ ਘਰ ਦੀਆਂ ਬਣਾਈਆਂ ਹੋਈਆਂ ਜਿਸ ਤਰ੍ਹਾਂ ਪੁਰਾਣੇ ਬਜ਼ੁਰਗਾਂ ਮਤਲਬ ਜਿਹੜੀਆਂ ਵੈਦ ਹਕੀਮਾਂ ਵਲੋਂ ਰਿਕਮੈਂਡਡ ਹੁੰਦੀਆਂ ਉਹਨੂੰ ਉਹ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹਦਾ ਇਨ ਮਾਹੌਲ ਤੋਂ ਬਚਾ ਰਹੇ ਜਾਂ ਵੈਸੇ